ਅੱਜ ਕੱਲ੍ਹ ਦੀ ਸੰਗੀਤ ਦਾ ਭਾਰਤ ਦੇਸ਼ ਵਿੱਚ ਵਿਕਾਸ ਵਧੀ ਹੀ ਜਾ ਰਿਹਾ ਹੈ ਲੋਕ ਤਾਂ ਸੰਗੀਤ ਨੂੰ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਦਿੰਦੇ ਹਨ ਅਤੇ ਲੋਕ ਸੰਗੀਤ ਦਾ ਭਾਰਤ ਦੇ ਪਾਸਟ ਨਾਲ ਬਹੁਤ ਹੀ ਵੱਡਾ ਇਹ ਸੰਬੰਧ ਹਨ ਲੋਕੀ ਅੱਜ ਕੱਲ ਸੰਗੀਤ ਨੂੰ ਬੜੇ ਹੀ ਪਿਆਰ ਨਾਲ ਗਾਉਂਦੇ ਹਨ ਸੰਗੀਤ ਹੀ ਬਹੁਤ ਹੀ ਜ਼ਿਆਦਾ ਵੱਖਰੇ ਵੱਖਰੇ ਤਰੀਕਿਆਂ ਦੇ ਹਨ ਜਿੱਦਾਂ ਡਰੋਕ ਮਿਊਜਿਕ ਪੋਪ ਮਿਊਜਿਕ ਅਤੇ ਹੋਰ ਵੀ ਬੜੇ ਕਲਾਸਿਕਲ ਮਿਊਜਿਕ ਹਨ ਲੋਕ ਸੰਗੀਤ ਨੂੰ ਸਮਝਦੇ ਹਨ ਕਿ ਉਹ ਸਾਡੇ ਦਿਲਾਂ ਵਿੱਚ ਵਸਦਾ ਹੋਇਆ ਲੋਕ ਕਦੀ ਵਾਰੇ ਲੋਕ ਜਦੋਂ ਬੜੇ ਡਿਪਰੈਸ਼ਨ 'ਚ ਹੁੰਦੇ ਹਨ ਜਾਂ ਲੋਕ ਖੁਸ਼ ਹੁੰਦੇ ਉਹ ਆ ਸੰਗੀਤ ਨੂੰ ਸੁਣ ਕੇ ਆਪਣੇ ਡਿਪਰੈਸ਼ਨ ਨੂੰ ਦੂਰ ਕਰਦੇ ਹਨ ਅਤੇ ਕੁਛ ਲੋਕ ਆਪਣੇ ਚੰਗੇ ਟਾਈਮ ਵਿੱਚ ਗੀਤਾਂ ਨੂੰ ਸੁਣ ਕੇ ਹੋਰ ਜ਼ਿਆਦਾ ਖੁਸ਼ ਹੁੰਦੇ ਹਨ ਅਤੇ ਆਪ ਭਾਵਨਾਵਾਂ ਨੂੰ ਲੋਕ ਦੂਜੇ ਲੋਕਾਂ ਨਾਲ ਵੀ ਸ਼ੇਅਰ ਕਰਦੇ ਹਨ ਸੰਗੀਤ ਨੂੰ ਜੇ ਕੋਈ ਬੰਦਾ ਆਪਣੇ ਹੁਨਰ ਨੂੰ ਸੁਧਾਰਨਾ ਚਾਹੁੰਦਾ ਹੈ ਸੰਗੀਤ ਦੇ ਤਾਂ ਅੱਜ ਕੱਲ੍ਹ ਬੜੇ ਜ਼ਿਆਦਾ ਇੱਦਾਂ ਦੇ ਐਪ ਬੜੇ ਜ਼ਿਆਦਾ ਇਦਾਂ ਦੇ ਪਲੈਟਫਾਰਮ ਵੀ ਆ ਗਏ ਹਨ ਜਿੱਥੇ ਉਹ ਜਾ ਕੇ ਸਿੱਖ ਸਕਦਾ ਹੈ ਆਪਣੇ ਸੰਗੀਤ ਨੂੰ ਸੁਧਾਰ ਸਕਦਾ ਹੈ ਜਿੱਦਾਂ ਕਿ ਅੱਜ ਕੱਲ੍ਹ ਹਰ ਇੱਕ ਸ਼ਹਿਰ ਵਿੱਚ ਇੱਦਾਂ ਦੇ ਕੋਚਿੰਗ ਸੈਂਟਰ ਆ ਗਏ ਹਨ ਜਿੱਥੇ ਜਾ ਕੇ ਬੰਦਾ ਸੰਗੀਤ ਦੀ ਪ੍ਰੈਕਟਿਸ ਕਰ ਸਕਦਾ ਹੈ ਉੱਥੇ ਜਾ ਕੇ ਬੰਦਾ ਸਿੱਖ ਸਕਦਾ ਹੈ ਕਿ ਸੰਗੀਤ ਨੂੰ ਕਿੱਦਾਂ ਸੁਧਾਰੀਏ ਉੱਥੇ ਜਾ ਕੇ ਕਲਾਸਾਂ ਲੈ ਸਕਦਾ ਹੈ ਕਿ ਸੰਗੀਤ ਨੂੰ ਕਿੱਦਾਂ ਵ ਨਿਖਾਰੀਏ ਅਤੇ ਸੰਗੀਤ ਅੱਜ ਕੱਲ੍ਹ ਮਸ਼ਹੂਰ ਵੀ ਬਹੁਤ ਹੋ ਗਿਆ ਅੱਜ ਕੱਲ੍ਹ ਤਾਂ ਇਹਨੂੰ ਪੂਰੇ ਦੁਨੀਆ 'ਚ ਵਿੱਚ ਪ੍ਰਮੋਟ ਕੀਤਾ ਜਾਂਦਾ ਹੈ ਉੱਤੋਂ ਇਹਦੇ 'ਤੇ ਪੂਰੀ ਦੁਨੀਆ ਵਿੱਚ ਕੰਪੀਟੀਸ਼ਨ ਵੀ ਹੁੰਦੇ ਹਨ ਜਿੱਥੇ ਜਾ ਕੇ ਹਰ ਦੇਸ਼ ਤੋਂ ਲੋਕ ਆਉਂਦੇ ਹਨ ਅਤੇ ਇੱਕ ਦੂਜੇ ਨਾਲ ਕੰਪੀਟ ਕਰਦੇ ਹਨ ਅਤੇ ਇਹਨੂੰ ਵਧਾਈ ਜਾਂਦੇ ਹਨ ਅਤੇ ਹੋਰ ਪ੍ਰੋਮੋਟ ਕਰੀ ਜਾਂਦੇ ਹਨ ਲੋਕਾਂ ਦਾ ਸੰਗੀਤ ਇੱਥੇ ਇੱਕ ਬਹੁਤ ਹੀ ਅਹਿਮ ਹਿੱਸਾ ਬਣ ਚੁੱਕਿਆ ਹੈ ਲੋਕਾਂ ਦੀ ਜ਼ਿੰਦਗੀ ਦਾ